ਹਾਂ ਮੈਂ ਦੌੜਦੇ ਸਮੇਂ ਅ ਸੱਟ ਦਾ ਅਨੁਭਵ ਕੀਤਾ ਹਾਂ ਇੱਕ ਵਾਰ ਮੈਂ ਗਰਾਉਂਡ ਦੇ ਵਿੱਚ ਰ ਅ ਰਨਿੰਗ ਕਰ ਰਿਹਾ ਸੀ ਤਾਂ ਮੇਰੇ ਸੱਟ ਲੱਗ ਗਈ ਅਤੇ ਮੈਂ ਅੱਗੇ ਦੌੜਣ ਦੌੜਨ ਤੋਂ ਮੈਂ ਪਰਹੇਜ਼ ਕਰ ਲਿਆ ਅਤੇ ਮੈਂ ਰੁਕ ਕੇ ਆਪਣੇ ਗੋਡੇ ਨੂੰ ਗੋਡੇ ਨੂੰ ਆਪਣੇ ਆਪਣੀ ਪੱਟੀ ਨਾਲ ਬੰਨ ਲਿਆ ਔਰ ਅਤੇ ਮੈਂ ਘਰ ਜਾ ਕੇ ਰੈਸਟ ਕੀਤੀ ਅਤੇ ਗੋਡੇ ਦੇ ਵਿੱਚ ਦਰਦ ਦਰਦ ਹੋ ਰਿਹਾ ਸੀ ਅਤੇ ਗੋਡੇ ਦੇ ਵਿੱਚ ਮੈਂ ਆਪਣੀ ਮਾਂ ਤੋਂ ਤੇਲ ਅਤੇ ਗਰਮ ਪੱਟੀ ਦੀ ਵਰਤੋਂ ਕਰਕੇ ਗਰਮ ਪੱਟੀ ਦੀ ਵਰਤੋਂ ਕਰਕੇ ਮੈਂ

ਕਦਮਾਂ ਦੇ ਨਾਲ ਅੱਗੇ ਤੁਰਦਾ ਗਿਆ ਅਤੇ ਮੈਂ ਆਪਣੇ ਗੋਡੇ ਨੂੰ ਗੋਡੇ ਨੂੰ ਹਿਲਾ ਕੇ ਦੇਖਿਆ ਤਾਂ ਮੇਰਾ ਗੋਡਾ ਦਰਦ ਕਰ ਰਿਹਾ ਸੀ ਕਿਉਂਕਿ ਮੈਂ ਦੌੜ ਨੂੰ ਆਪਣੀ ਹੋਬੀਸ ਮੰਨਦਾ ਹਾਂ ਅਤੇ ਮੈਂ ਇਸ ਨਾਲ ਮੈਨੂੰ ਦੌੜ ਨਾਲ ਬਹੁਤ ਜ਼ਿਆਦਾ ਪਿਆਰ ਹੈ ਅਤੇ ਮੈਂ ਇਹਨੂੰ ਛੱਡ ਨਹੀਂ ਸਕਦਾ ਅਤੇ ਇੱਕ ਮੈਂ ਅ ਮੈਂ ਇੱਕ ਬਹੁਤ ਵੱਡਾ ਅਨੁਭਵ ਅਨੁਭਵ ਕੀਤਾ ਕਿ ਸੜਕ 'ਤੇ ਭੱਜਣ ਨਾਲੋਂ ਤੁਸੀਂ ਗਰਾਊਂਡ ਦੇ ਵਿੱਚ ਭੱਜੋ ਤਾਂ ਤੁਹਾਨੂ ਸੱਟਾਂ ਘੱਟ ਲੱਗਣਗੀਆਂ ਅਤੇ ਸੜਕ ਤੋਂ ਭੱਜਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਸੜਕ 'ਤੇ ਭੱਜਣ ਨਾਲ ਕੀ ਹੁੰਦਾ ਗਾ ਆਪਣੇ ਜਿਹੜੇ ਗੋਡਿਆਂ ਦਾ ਦਰਦ ਜ਼ਿਆਦਾ ਹੁੰਦਾ ਹੈ ਅਤੇ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਅਤੇ ਜਿਸ ਨਾਲ ਅ ਜਿਸ ਨਾਲ ਸਾਡੇ ਗੋਡਿਆਂ ਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਅਤੇ ਭੱਜਣ ਦੇ ਵਿੱਚ ਦਿੱਕਤ ਆਉਂਦੀ ਹੈ ਅਤੇ ਮੈਂ ਮੈਂ ਇਹ ਫ ਇਹ ਅਨੁਭਵ ਕੀਤਾ ਕਿ ਮੈਂ ਹੁਣ ਗਰਾਊਂਡ ਪਲੇ ਜਾਂ ਦੌੜ ਟਰੈਕ ਦੇ ਵਿੱਚ ਹੀ ਭੱਜਾਂਗਾ ਅਤੇ ਅਤੇ ਆਪਣੇ ਆਪਣੇ ਧਿਆਨ ਨਾਲ ਆਪਣੇ ਆਪਣੇ ਧਿਆਨ ਨਾਲ ਅਤੇ ਅੱਛੇ ਅੱਛੇ ਕੁਆਲਿਟੀ ਦੇ ਬੂਟ ਦੀ ਵਰਤੋਂ ਕਰਾਂਗਾ ਅਤੇ ਜਿਸ ਨਾਲ ਮੈਂ ਆਪਣੇ ਅ ਸਰੀਰ ਅਤੇ ਆਪਣੀ ਹੈਲਥ ਨੂੰ ਸਹੀ ਕਰ ਸਕਾਂ ਦੌੜਦੇ ਸਮੇਂ ਅ ਦੌੜਦੇ ਸਮੇਂ ਹਰ ਇੱਕ ਮਨੁੱਖ ਹਰ ਇੱਕ ਮਨੁੱਖ ਹਰ ਇੱਕ ਪਲਿਅਰ ਅ ਗਰਾਊਂਡ ਦੇ ਵਿੱਚ ਹਰੇਕ ਨੂੰ ਕੀ ਆ ਸੱਟਾਂ ਦਾ ਅਨੁਭਵ ਕਰਨਾ ਪੈਂਦਾ ਹੈ ਅਤੇ ਪਲਿਅਰ ਨੂੰ ਅਥਲੀਟ ਨੂੰ ਕਦੇ ਵੀ ਅ ਕਦੇ ਵੀ ਨੈਗੇਟਿਵ ਨਹੀਂ ਹੋਣਾ ਚਾਹੀਦਾ ਅਤੇ ਸਗੋਂ ਐਪਰੀਸ਼ੇਟ ਅੱਗੇ ਹੋ ਕੇ ਕੀ ਹੈ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੀ ਆਪਣੀ ਰਨਿੰਗ ਨੂੰ ਅਤੇ ਆਪਣੇ ਫੋਕਸ ਨੂੰ ਗੋਲ ਨੂੰ ਟਾਰਗੇਟ ਨੂੰ ਅੱਗੇ ਰੱਖਣਾ ਚਾਹੀਦਾ ਹੈ ਅਤੇ ਦੌੜਦੇ ਸਮੇਂ ਤਾਂ ਇਹ ਜ਼ਿੰਦਗੀ ਦਾ ਕੀ ਹੈ ਇੱਕ ਪਾਰਟ ਆ ਸੱਟਾਂ ਆਪਣਾ ਪਾਰਟ ਹੈ ਅਤੇ ਇਹਨਾਂ ਨੂੰ ਅਸੀਂ ਆਪਣੇ ਆਪਣੇ ਆਪਣੇ ਅਕੋਰਡਿੰਗ ਵੀ ਠੀਕ ਕਰ ਸਕਦੇ ਹਾਂ ਜੇਕਰ ਆਪਣੀ ਸੱਟ ਕੀ ਹੈ ਜ਼ਿਆਦਾ ਗੰਭੀਰ ਹੈ ਤਾਂ ਆਪਾਂ ਕੀ ਹੈ ਆਪਣੇ ਏਰੀਏ ਦੇ ਸ਼ਹਿਰ ਜਾਂ ਪਿੰਡ ਦੇ ਵਿੱਚ ਹੀ ਕੀ ਆ ਡਾਕਟਰ ਤੋਂ ਸਲਾਹ ਲੈ ਕੇ ਆਪਾਂ ਰੈਸਟ ਅਤੇ ਦਵਾਈ ਦੀ ਵਰਤੋਂ ਕਰ ਸਕਦੇ ਹਾਂ ਅਤੇ ਇਹਨੂੰ ਆਪਾਂ ਖੁਦ ਵੀ ਅ ਇ ਇ ਠੀਕ ਕਰ ਸਕਦੇ ਹਾਂ ਅਤੇ ਕੀ ਆ ਦੌੜਦੇ ਸਮੇਂ ਸੱਟਾਂ ਦਾ ਅਨੁਭਵ ਹਰ ਇੱਕ ਮਨੁੱਖ ਕਰਦਾ ਹੈ ਹਰ ਇੱਕ ਅਥਲੀਟ ਕਰਦਾ ਹੈ ਅਤੇ ਉਹਨਾਂ ਨੂੰ ਆਪਾਂ ਖੁਦ ਵੀ ਸੰਭਾਲ ਸਕਦੇ ਹਾਂ ਅਤੇ ਠੀਕ ਵੀ ਕਰ ਸਕਦੇ ਹਾਂ